ਹਾਂਜੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਜਦੋਂ ਔਨਲਾਈਨ ਸ਼ੋਪਿੰਗ ਕੀਤੀ ਅਤੇ ਮੈਂ ਸੋਚਿਆ ਵੀ ਇੱਕ ਨਵਾਂ ਮੋਬਾਈਲ ਫੋਨ ਕਿਉਂ ਨਾ ਲਿਆ ਜਾਵੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਵੀ ਡਰ ਸੀ ਵੀ ਔਨਲਾਈਨ ਸ਼ੋਪਿੰਗ ਕਰਨੀ ਆ ਮੇਰਾ ਪੈਸਾ ਖਰਾਬ ਨਾ ਹੋ ਜਾਵੇ ਚੀਜ਼ ਵਧੀਆ ਨਿਕਲੇ ਜਾਂ ਨਾ ਨਿਕਲੇ ਬੜਾ ਮਨ ਸੀ ਅਤੇ ਕਿਤੇ ਨਾ ਕਿਤੇ ਮਨ 'ਚ ਐਕਸਾਈਟਿਡ ਵੀ ਸੀ ਵੀ ਮੈਂ ਇੱਕ ਨਵਾਂ ਫੋਨ ਲੈਣਾ ਔਰ ਮੈਂ ਫਿਰ ਫੋਨ ਦੇ ਵਿੱਚ ਕਾਫੀ ਸਰਚ ਕੀਤੇ ਵਧੀਆ ਵਧੀਆ ਫੋਨ ਕਾਫੀ ਸਕਰੋਲ ਕੀਤਾ ਵੀ ਇੱਧਰ ਉੱਧਰ ਦੇਖਿਆ ਸਾਰੇ ਕੋਪ ਕੰਪਨੀਆਂ ਦੇ ਦੇਖੇ ਵੀ ਮੇਰੀ ਪਹੁੰਚ ਦੇ ਵਿੱਚ ਕਿਹੜਾ ਫੋਨ ਹੋ ਸਕਦਾ ਕਿਹੜਾ ਫੋਨ ਨਹੀਂ ਹੋ ਸਕਦਾ ਕਾਫੀ ਜ਼ਿਆਦਾ ਸਕਰੋਲਿੰਗ ਕਰਨ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਓਪੋ ਓਪੋ ਓਪੋ ਕੋਂਪਨੀ ਦਾ ਫੋਨ ਲਿਆ ਜਾਵੇ ਫਿਰ ਓਪੋ ਦੇ 'ਤੇ ਕਾਫੀ ਸਰਚ ਕੀਤਾ ਓਪੋ ਦੇ ਵਿੱਚ ਮੈਨੂੰ ਵੀ ਫੋਨ ਵਧੀਆ ਲੱਗਾ ਐੱਫ ਐੱਫ ਥ੍ਰੀ ਐੱਫ ਟਵੈਂਟੀ ਥ੍ਰੀ ਫੋਨ ਵਧੀਆ ਬਹੁਤ ਲੱਗਾ ਉਹਦੇ ਵਿੱਚ ਕਾਫੀ ਕਲਰ ਸੀ ਬਹੁਤ ਕਲਰ ਸੀ ਪਰ ਮੈਨੂੰ ਉਹਦੇ ਵਿੱਚ ਗੋਲਡ ਕਲਰ ਬਹੁਤ ਵਧੀਆ ਲੱਗਾ ਗੋਲਡ ਕਲਰ ਦਾ ਮੇਰਾ ਮਨ ਵੀ ਸੀ ਵੀ ਮੈਂ ਉਹਦਾ ਲਿਆ ਫੋਨ ਲਵਾਂ ਉਸ ਦੀ ਜਿਹੜੀ ਰੈਮ ਸੀ ਉਹ ਅੱਠ ਜੀ ਵੀ ਸੀ ਅਤੇ ਦੋ ਸੌ ਛਪੰਜਾ ਜੀ ਵੀ ਸਟੋਰੇਜ ਸੀ ਜੋ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਪੰਜ ਸੌ ਮੈਗਾਹਾਰਡ ਐਂਡ ਬੈਟਰੀ ਉਹਦੀ ਸਤਾਹਟ ਵਾਟ ਦੀ ਸੀ ਅਤੇ ਜੋ ਮਤਲਬ ਮੈਨੂੰ ਬਹੁਤ ਵਧੀਆ ਲੱਗਾ ਵੀ ਮੇਰੇ ਪਹੁੰਚ ਦੇ ਵਿੱਚ ਵੀ ਹੈ ਔਰ ਮਤਲਵ ਮੈਨੂੰ ਉਹਦੇ ਫੀਚਰਸ ਵੀ ਬਹੁਤ ਵਧੀਆ ਲੱਗੇ ਜੋ ਜੋ ਉਹਦੇ ਫੀਚਰ ਸੀ ਸਭ ਕੁਛ ਬਹੁਤ ਵਧੀਆ ਲੱਗਾ ਇੱਕ ਉਹਦਾ ਮੈਨੂੰ ਰੇਟ ਸਭ ਤੋਂ ਵਧੀਆ ਲੱਗਾ ਵੀ ਮੇਰੀ ਪਹੁੰਚ ਦੇ ਵਿੱਚ ਵਿੱਚ ਸੀ ਅਤੇ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਅਤੇ ਉਹਦੀ ਸਟੋਰੇਜ ਵੀ ਬਹੁਤ ਵਧੀਆ ਸੀ ਇੱਕ ਉਹ ਹੈ ਨਵੇਂ ਟਾਈਮ ਦਾ ਸੀ ਜਿਵੇਂ ਅੱਜ ਕੱਲ੍ਹ ਫਾਈਵ ਜੀ ਚੱਲ ਪਿਆ ਫਾਈਵ ਜੀ ਫਾਈਵ ਜੀ ਦਾ ਸੀ ਉਹ ਫੋਨ ਜੋ ਕਿ ਮੇਰੇ ਮਨ ਨੂੰ ਬਹੁਤ ਵਧੀਆ ਲੱਗਾ ਵੀ ਮੈਂ ਇਹ ਲੈ ਰਹੀ ਹਾਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਫੋਨ ਨੂੰ ਔਡਰ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਮਨ 'ਚ ਇਹ ਵੀ ਮੇਰਾ ਫੋਨ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਵੇ ਚਲੋ ਜਦੋਂ ਮੇਰਾ ਫੋਨ ਮੇਰੇ ਕੋਲ ਆਇਆ ਡਿਲੀਵਰ ਹੋਇਆ ਮੇਰੇ ਕੋਲ ਹੋਮ ਡਿਲੀਵਰੀ ਉਹਨਾਂ ਨੇ ਕੀਤੀ ਮੈਂ ਉਹਨਾਂ ਨੂੰ ਪੇਮੈਂਟ ਕੀਤੀ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਚਲਾ ਕੇ ਦੇਖਿਆ ਤਾਂ ਮੇਰਾ ਮਨ ਬਹੁਤ ਖੁਸ਼ ਹੋਇਆ ਕਿਤੇ ਨਾ ਕਿਤੇ ਮੇਰੇ ਮਨ 'ਚ ਜੋ ਔਨਲਾਈਨ ਸ਼ੌਪਿੰਗ ਦੇ ਪ੍ਰਤੀ ਡਰ ਸੀ ਵੀ ਪੈਸਾ ਫਰੋਡ ਹੋ ਜਾਣਾ ਮੇਰਾ ਪੈਸਾ ਵੇਸਟ ਨਾ ਚਲ ਜਾਵੇ ਉਹ ਚੀਜ਼ ਮੈਨੂੰ ਨਹੀਂ ਮਿਲੀ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਪੈਸੇ ਦਾ ਮੁੱਲ ਮੈਨੂੰ ਮੁੜ ਗਿਆ ਤਾਂ ਮੈਨ ਮਤਲਬ ਜੋ ਮੈਂ ਚੀਜ਼ ਚਾਹੁੰਦੀ ਸੀ ਫੀਚਰਜ ਚਾਹੁੰਦੀ ਸੀ ਫੋਟੋ ਦੀ ਕੁਆਲਿਟੀ ਚਾਹੁੰਦੀ ਸੀ ਉਹ ਸਭ ਕੁਛ ਬਹੁਤ ਵਧੀਆ ਸੀ ਇਸ ਕਰਕੇ ਮੈਂ ਔਨਲਾਈਨ ਸ਼ੋਪਿੰਗ ਨੂੰ ਤਰਜ਼ੀਹ ਦਿੰਦੀ ਹਾਂ ਵੀ ਹਾਂ ਬਹੁਤ ਵਧੀਆ ਵੀ ਲੋਕਾਂ ਨੂੰ ਕਰਨੀ ਚਾਹੀਦੀ ਹੈ ਪਰ ਇੱਕ ਵਧੀਆ ਹੀ ਕੰਪਨੀ ਤੋਂ ਔਨਲਾਈਨ ਸ਼ੋਪਿੰਗ ਕਰਨੀ ਚਾਹੀਦੀ ਐਵੇਂ ਨਹੀਂ ਕਿ ਕਿਤੋਂ ਵੀ ਜਾ ਕੇ ਔਨਲਾਈਨ ਸ਼ੋਪਿੰਗ ਕੀਤੀ ਜਾਵੇ ਧੰਨਵਾਦ ਜੀ